ਮਹੱਤਵਪੂਰਨ ਫੈਸਲੇ ਦੀ ਗੱਲ ਕਰੀਏ ਤਾਂ ਜਿ ਜ਼ਿੰਦਗੀ 'ਚ ਬਹੁਤ ਸਾਰੇ ਮੌਕੇ ਇਹੋ ਜਿਹੇ ਆਉਂਦੇ ਨੇ ਜਦੋਂ ਤੁਹਾਨੂੰ ਬੜੇ ਸਾਰੇ ਜਿਹੜਾ ਫੈਸਲਾ ਲੈਣਾ ਬੜਾ ਔਖਾ ਵੀ ਹੁੰਦਾ ਅਤੇ ਪਰ ਉਹ ਫੈਸਲਾ ਬੜਾ ਜ਼ਰੂਰੀ ਵੀ ਹੁੰਦਾ ਜਿਹੜਾ ਤੁਹਾਨੂੰ ਇੱਕਦਮ ਸੋਚ ਕੇ ਲੈਣਾ ਪੈਂਦਾ ਅਤੇ ਇੱਦਾਂ ਦਾ ਇੱਕ ਮੌਕਾ ਆਇਆ ਜਦੋਂ ਮੇਰੇ ਸਹੁਰਾ ਸਾਹਿਬ ਦਾ ਐਕਸੀਡੈਂਟ ਹੋ ਗਿਆ ਮੈਨੂੰ ਅਚਾਨਕ ਖਬਰ ਮਿਲੀ ਵੀ ਉਹਨਾਂ ਦਾ ਜੀ ਉਹਨਾਂ ਦੇ ਵਿੱਚ ਕਿਸੇ ਨੇ ਵੀ ਮੋਟਰਸਾਈਕਲ ਮਾਰਿਆ ਅਤੇ ਉਹ ਗਿਰ ਗਏ ਅਤੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਉਹਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਅਸੀਂ ਇਮੀਡੇਟਲੀ ਚੱਕ ਕੇ ਉਹਨਾਂ ਨੂੰ ਹਸਪਤਾਲ ਲੈ ਗਏ ਹਸਪਤਾਲ 'ਚ ਜਾ ਕੇ ਉਹਨਾਂ ਦਾ ਐਕਸਰੇ ਕਰਵਾਇਆ ਅਤੇ ਸਾਰਾ ਅੱਗੇ ਕੁਛ ਡਾਕਟਰਾਂ ਨੇ ਉਹ ਕਰਿਆ ਉਹ ਕਹਿੰਦੇ ਦੋ ਘੰਟੇ ਉਡੀਕੋ ਉਹ ਤੋਂ ਬਾਅਦ ਤੁਹਾਡੀ ਜਿਹੜੀ ਰਿਪੋਰਟਾਂ ਮਿਲਣਗੀਆਂ ਫਿਰ ਅਸੀਂ ਕੁਛ ਕਹਿ ਸਕਦੇ ਹਾਂ ਵੀ ਸਿਰ ਦੀ ਸੱਟ ਕਿੱਦਾਂ ਦੀ ਹੈ ਵੀ ਤੁਹਾਨੂੰ ਇੱਥੇ ਰੱਖਾਂਗੇ ਕਿ ਕਿਤੇ ਹੋਰ ਲੈ ਕੇ ਜਾਣਾ ਪਊਗਾ ਤਾਂ ਮੈਨੂੰ ਦੋ ਘੰਟੇ ਬਾਅਦ ਜਦੋਂ ਜੀ ਰਿਪੋਰਟ ਮਿਲੀ ਤਾਂ ਮੈਨੂੰ ਡਾਕਟਰ ਨੇ ਦੇਖੀ ਰਿਪੋਰਟ ਸਿਰ ਦੇ ਵਿੱਚ ਕਾਫੀ ਸੱਟ ਸੀ ਕਹਿੰਦੇ ਜੀ ਖੂਨ ਅੰਦਰ ਡਿੱਗਣ ਲੱਗ ਗਿਆ ਅਤੇ ਤੁਹਾਨੂੰ ਤਾਂ ਇੱਕਦਮ ਜਿਹੜੀ ਜੀ ਅਸੀਂ ਰੈਫਰ ਕਰਾਂਗੇ ਸਰਕਾਰੀ ਹਸਪਤਾਲ ਚੰਡੀਗੜ੍ਹ ਲੈ ਕੇ ਜਾਣਾ ਪੈਣਾ ਤੁਹਾਨੂੰ ਅਤੇ ਤੁਸੀਂ ਆਪਣਾ ਡਿਸਾਈਡ ਕਰ ਲਉ ਵੀ ਤੁਸੀਂ ਪਟਿਆਲੇ ਜਾਣਾ ਕਿ ਚੰਡੀਗੜ ਜਾਣਾ ਮੈਂ ਜੀ ਇੱਕਦਮ ਕੱਲੀ ਸੀਗੀ ਨਾਲ ਕੋਈ ਨਹੀਂ ਸੀ ਅਤੇ ਉਹ ਪਲ ਜਿਹੜੇ ਮੇਰੇ ਲਈ ਬੜੇ ਹੀ ਔਖੇ ਸੀਗੇ ਅਤੇ ਮੈਨੂੰ ਬੜਾ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਸੀਗੀ ਕਿਉਂਕਿ ਮੈਨੂੰ ਇਹ ਵੀ ਦੇਖਣਾ ਪੈਣਾ ਸੀ ਵੀ ਅੱਗੇ ਪਿੱਛੇ ਘਰ ਬਾਰ ਕੋਣ ਸੰਭਾਲੇਗਾ ਅਤੇ ਮੇਰੇ ਕੋਲ ਹਸਪਤਾਲ ਦੇ ਵਿੱਚ ਕੌਣ ਰਹੇਗਾ ਅਤੇ ਇਹ ਫੈਸਲਾ ਓਨਾ ਹੀ ਜ਼ਿੰਦਗੀ ਨਾਲ ਜੁੜਿਆ ਹੋਇਆ ਸੀ ਉਹ ਮੈਨੂੰ ਕਹਿ ਰਹੇ ਸੀ ਵੀ ਫਟਾਫਟ ਤੁਸੀਂ ਲੈ ਜਾਓ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਹੋ ਸਕਦਾ ਜੇ ਇਹਨਾਂ ਦੇ ਅੰਦਰ ਉਹ ਹੋਇਆ ਹੋਇਆ ਤਾਂ ਦੋ ਘੰਟੇ ਹੋ ਗਏ ਆਲਰੇਡੀ ਤਾਂ ਤੁਹਾਨੂੰ ਹੋਰ ਜ਼ਿਆਦਾ ਔਖਾ ਹੋਣਾ ਪੈ ਸਕਦਾ ਅਤੇ ਮੈਂ ਜੀ ਫਿਰ ਬਹੁਤ ਸੋਚ ਕੇ ਇਹ ਫੈਸਲਾ ਇਹ ਸੀਗਾ ਵੀ ਹਾਂ ਜ਼ਿੰਦਗੀ ਮੌਤ ਦਾ ਸਵਾਲ ਸੀ ਤਾਂ ਕਰਕੇ ਮੇਰੇ ਲਈ ਬਹੁਤ ਮਹੱਤਵਪੂਰਨ ਵੀ ਸੀਗਾ ਅਤੇ ਉੱਪਰੋਂ ਦੀ ਉਹਨਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਸੀ ਮੇਰੇ ਨਾਲ ਮੇਰੇ ਬਜ਼ੁਰਗ ਮੇਰੇ ਮਤ ਮਾਤਾ ਜੀ ਸੀਗੇ ਅਤੇ ਮੈਂ ਸਾਰਾ ਜਿਹੜਾ ਭਾਰ ਸੀਗਾ ਉਹ ਸਾਰਾ ਮੇਰੇ 'ਤੇ ਸੀ ਅਤੇ ਮੈਂ ਸੋਚ ਕੇ ਬਹੁਤ ਫਿਰ ਮੈਂ ਇਹ ਜੀ ਸੋਚਿਆ ਵੀ ਮੈਂ ਹੁਣ ਦੇਖੀ ਜਾਵੇਗਾ ਜਿਵੇਂ ਹੋਊਗਾ ਅੱਗੇ ਅਤੇ ਮੈਨੂੰ ਚੰਡੀਗੜ੍ਹ ਰੈਫਰ ਮੈਂ ਇੱਕਦਮ ਇਹ ਫੈਸਲਾ ਲਿਆ ਡਾਕਟਰ ਨੂੰ ਮੈਂ ਕਿਹਾ ਅਤੇ ਉਹਨਾਂ ਨੇ ਮੈਨੂੰ ਫਟਾਫਟ ਰੈਫਰ ਕੀਤਾ ਫਿਰ ਅੱਗੇ ਮੇਰੇ ਲਈ ਅੱਗੇ ਜਿਹੜੇ ਸੀਗੇ ਬਹੁਤ ਚੀਜ਼ਾਂ ਹੋਰ ਦੇਖਣ ਵਾਲੀਆਂ ਸੀ ਜਿਹੜੀਆਂ ਮੈਨੂੰ ਬੜੀਆਂ ਸੋਚ ਸਮਝ ਕੇ ਵੀ ਮੈਂ ਜਾਣਾ ਕਿੱਦਾਂ ਹੈ ਉਹਨਾਂ ਨੂੰ ਲੈ ਕੇ ਕਿਵੇਂ ਜਾਣਾ ਅੱਗੇ ਮੈਨੂੰ ਕੌਣ ਦੇਖੇਗਾ ਇਸ ਕਰਕੇ ਇਹ ਬੜਾ ਜਿਹੜਾ ਫੈਸਲਾ ਔਖਾ ਸੀ ਜਿਹੜਾ ਮੈਨੂੰ ਬੜੀਆਂ ਚੀਜ਼ਾਂ ਸੋਚ ਕੇ ਲੈਣਾ ਪੈਣਾ ਸੀ ਮੇਰੇ ਬੱਚੇ ਦੀ ਦੇਖ ਭਾਲ ਕੌਣ ਕਰੇਗਾ ਸਾਰਾ ਕੁਛ ਸੋਚ ਸੰਭਾਲ ਕੇ ਜੀ ਫਟਾਫਟ ਮੈਂ ਡਕ ਕਾਰ ਵਾਲੇ ਨੂੰ ਫੋਨ ਕੀਤਾ ਅਤੇ ਟੈਕਸੀ ਦਾ ਅਰੇਂਜਮੈਂਟ ਕੀਤਾ ਅਤੇ ਲਿਜਾ ਕੇ ਨਾਲ ਉਹਨਾਂ ਨੂੰ ਫਟਾਫਟ ਅੱਗੇ ਡਕ ਕੰਟੈਕਟ ਕੀਤਾ ਆਪਦੇ ਰਿਸ਼ਤੇਦਾਰਾਂ ਨਾਲ ਜਿਹੜੇ ਅੱਗੇ ਸਾਂਭ ਸਕਣ ਅਤੇ ਤਾਂ ਜਾ ਕੇ ਜੀ ਮੇਰਾ ਇਹ ਹੋਇਆ ਫਿਰ ਮੈਂ ਅੱਗੇ ਸਲਾਹ ਹੁਣ ਕਿਹਦੀ ਲਵਾਂ ਫਿਰ ਮੈਂ ਆਪਦੇ ਪਿਤਾ ਜੀ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਦੱਸਿਆ ਜੀ ਵੀ ਡਾਕਟਰ ਮੇਰੇ ਅੱਗੇ ਚਾਚਾ ਜੀ ਡਾਕਟਰ ਨੇ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਅਤੇ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਹਾਂ ਜਦੋਂ ਕੋਈ ਵੀ ਜਿਹੜਾ ਇੱਦਾਂ ਦਾ ਮੈਡੀਕਲ ਵਿਸ਼ੇ ਦੇ ਨਾਲ ਕੰਮ ਹੁੰਦਾ ਕਿਉਂਕਿ ਉਹ ਖੁਦ ਡਾਕਟਰ ਨੇ ਉਹ ਵਧੀਆ ਰਿਕਮੈਂਡੇਸ਼ਨ ਦਿੰਦੇ ਨੇ ਤਾਂ ਫਿਰ ਮੈਂ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਅਤੇ ਉਹਨਾਂ ਦੀ ਸਰਜਰੀ ਹੋਈ ਜੀ ਸੋ ਇਸ ਤਰ੍ਹਾਂ ਨਾਲ ਮੈਨੂੰ ਬੜਾ ਮਹੱਤਵਪੂਰਨ ਫੈਸਲਾ ਸੀ ਜਿਹੜਾ ਜੀ ਮੈਨੂੰ ਲੈਣਾ ਪਿਆ ਅਤੇ ਕਈ ਵਾਰੀ ਇੱਦਾਂ ਦੇ ਮੌਕੇ ਆਉਂਦੇ ਨੇ ਜਦੋਂ ਸਾਨੂੰ ਇਹ ਸੀ ਸਾਰੀਆਂ ਚੀਜ਼ਾਂ ਬੜੀਆਂ ਸੋਚ ਵਿਚਾਰ ਕਰਨੀਆਂ ਪੈਂਦੀਆਂ